ਭੰਗੜਾ ਕਰਦੇ ਸਮੇਂ ਪਹਿਨੇ ਜਾਣ ਵਾਲੇ ਪਹਿਰਾਵੇ ਰੰਗ ਬਿਰੰਗੇ ਅਤੇ ਪੁਰਾਣੀ ਪੰਜਾਬੀ ਸੰਸਕ੍ਰਿਤੀ ਨੂੰ ਦਰਸਾਉਂਦਾ ਹੈ ਜਿਵੇਂ ਕਿ ਕੁੜਤਾ ਚਾਦਰਾ ਕੰਦਾ ਪੱਗ ਫੁਫਣ ਜਿ ਜੇ ਆਪਾਂ ਗੱਲ ਕਰੀਏ ਕੁੜਤੇ ਦੀ ਢਿੱਲਾ ਅਤੇ ਲੰਬੀ ਕਮੀਜ਼ ਵਰਗਾ ਪਹਿਰਾਵਾ ਜੋ ਆ ਆਮਦ੍ਰਿਕ ਹੁੰਦਾ ਹੈ ਚਾਦਰਾ ਜਾਂ ਲੂੰਗੀ ਵੀ ਕਹਿ ਸਕਦੇ ਹਨ ਅਤੇ ਇਹਦੇ ਨਾਲ ਹੀ ਜੇ ਆਪਾਂ ਗੱਲ ਕਰੇ ਔਰਤਾਂ ਜਾਂ ਲੜਕੀਆਂ ਦੀ ਭੰਗੜੇ ਦੀ ਪੋਸ਼ਾਕ ਦੀ ਉਹ ਸਲਵਾਰ ਕਮੀਜ਼ ਅਤੇ ਦੁਪੱਟਾ ਲੈਂਦੀਆਂ ਹਨ ਇਹ ਪਹਿਰਾਵਾ ਆਕਰਸ਼ਿਤ ਹੈ ਜੋ ਕਿ ਭੰਗੜਾ ਜਿਸ ਵਿੱਚ ਪਾਇਆ ਜਾਂਦਾ ਹੈ ਜਦੋਂ ਭੰਗੜਾ ਪਾਇਆ ਜਾਂਦਾ ਹੈ ਤਾਂ ਉਹ ਢੋਲ 'ਤੇ ਪਾਇਆ ਜਾਂਦਾ ਹੈ ਜਿਹਦੇ ਇਹ ਭੰਗੜਾ ਅਤੇ ਐਕਰੋਬੈਕਸ ਇਹੋ ਜਿਹੀ ਚੀਜ਼ਾਂ ਹਨ ਜਿਸ ਵਿੱਚ ਆਪਾਂ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਨ ਅਤੇ ਸਾਡਾ ਬੋਡੀ ਦਾ ਟੈਂਪਰੇਚਰ ਵੀ ਵਧਿਆ ਰਹਿੰਦਾ ਹੈ ਭੰਗੜੇ ਅਤੇ ਐਕਰੋਬੈਕਸ ਏਦਾਂ ਦੀ ਚੀਜ਼ਾਂ ਹਨ ਜਿਹਦੇ ਵਿੱਚ ਆਪਾਂ ਪੈਸੇ ਵੀ ਕਮਾ ਸਕਦੇ ਹਾਂ ਕਈ ਲੋਕ ਭੰਗੜਾ ਜਾਂ ਐਕਰੋਬੈਕਸ ਸਿਖਾ ਕੇ ਲੋਕਾਂ ਤੋਂ ਪੈਸੇ ਲੈਂਦੇ ਹਨ ਜਿਸ ਕਰਕੇ ਉਹ ਪੇਮ